ਪੰਦਰਾਂ ਮਾਰਚ ਉੱਨੀ ਸੌ ਕੱਤੀ ਵੀਹ ਅਗਸਤ ਉੱਨੀ ਸੌ ਪੰਜਾਹ ਤੇਈ ਨਵੰਬਰ ਉੱਨੀ ਸੌ ਅੱਸੀ ਪੱਚੀ ਜਨਵਰੀ ਵੀਹ ਸੌ ਵੀਹ ਉਣੱਤੀ ਜੁਲਾਈ ਦੋ ਹਜ਼ਾਰ ਇੱਕੀ